ਹੈਲੋ ਸਤਿ ਸ਼੍ਰੀ ਅਕਾਲ ਬੇਟਾ ਹਾਂਜੀ ਵਧੀਆ ਤੁਸੀਂ ਸੁਣਾਓ ਬੇਟਾ ਵਧ ਤੁਹਾਡੀ ਕਿਵੇਂ ਰਹੀ ਦੀਵਾਲੀ ਅੱਛਾ ਅੱਛਾ ਪਹਿਲਾਂ ਦੀ ਟਾਈਮਿੰਗ ਚਾਰ ਵਜੇ ਦੀ ਸੀ ਪਰ ਹੁਣ ਮੌਸਮ ਚੇਂਜ ਹੋ ਰਿਹਾ ਨਾ ਤਾਂ ਕਰਕੇ ਮੈਂ ਟਾਈਮਿੰਗ ਤਿੰਨ ਵਜੇ ਦੀ ਕਰਤੀ ਆ

ਅੱਛਾ ਫਿਰ ਤੁਸੀਂ ਐਂ ਕਰ ਲਓ ਅਜ ਕੱਲ ਲੇਟ ਆ ਜਿਓ ਬਾਕੀ ਆਪਾਂ ਬਾਅਦ 'ਚ ਦੇਖ ਲਵਾਂਗੇ ਤੁਹਾਡਾ ਟਾਈਮ ਕਿਸ ਹਿਸਾਬ ਨਾਲ ਸੈਟ ਕਰਨਾ ਅੱਛਾ ਸਵੇਰੇ ਤੁਹਾਡਾ ਸਕੂਲ ਕਿੰਨੇ ਵਜੇ ਲੱਗਦਾ ਅੱਛਾ ਚਲੋ ਫਿਰ ਇਹ ਤਾਂ ਫਿਰ ਸਾਰਿਆਂ ਨਾ ਸਾਰਿਆਂ ਨਾ ਗੱਲਬਾਤ ਕਰਕੇ ਫੇਰ ਹੀ ਟਾਈਮਿੰਗ ਚੇਂਜ ਕਰਾਂਗੇ ਨਾ ਕਿਉਂਕਿ ਬਾਕੀ ਬੱਚਿਆਂ ਦਾ ਵੀ ਅਲੱਗ ਰੂਟੀਨ ਬਣਿਆ ਹੋਇਆ ਤਾਂ ਉਹਨਾਂ ਨੂੰ ਪੁੱਛ ਕੇ ਫਿਰ ਹੀ ਕਰਾਂਗੇ ਕੱਲ ਕਰ ਲਵਾਂਗੇ ਟਾਈਮਿੰਗ ਦਾ ਸੈਟ ਹਾਂਜੀ ਹੋਰ ਕੋਈ ਪਰੇਸ਼ਾਨੀ ਤੁਹਾਨੂੰ ਬੇਟਾ ਜਾਣ ਪਹਿਚਾਣ ਤਾਂ ਬਣਾਉਗੇ ਤਾਂ ਹੀ ਬਣੇਗੀ ਨਾ ਤੁਸੀਂ ਉਹਨਾਂ ਨਾਲ ਗੱਲਬਾਤ ਕਰੋ ਮਤਲਬ ਕਿ ਆਪਣੀ ਹੋਬਿਜ ਵਗੈਰਾ ਦੱਸੋ ਭੰਗੜੇ ਬਾਰੇ ਕੁਛ ਦੱਸੋ ਫਿਰ ਉਹਨਾਂ ਨਾਲ ਤੁਹਾਡੀ ਹੋਰ ਜਾਣ ਪਹਿਚਾਣ ਬਣ ਜਾਵੇਗੀ ਕਿਉਂਕਿ ਜੇਕਰ ਤੁਸੀਂ ਆਪਣੇ ਅ ਸਹੇਲੀਆਂ ਨਾਲ ਹੀ ਰਹੋਗੇ ਤਾਂ ਤੁਹਾਡੀ ਬਾਕੀਆਂ ਨਾਲ ਕਿੱਦਾਂ ਜਾਣ ਪਹਿਚਾਣ ਬਣੇਗੀ ਹੈ ਨਾ

ਹਾਂਜੀ ਹੋਰ ਕੁਛ ਅੱਛਾ ਪਹਿਲਾਂ ਤੁਹਾਡੇ ਕੋਲ ਕਿਹੜਾ ਨੰਬਰ ਸੀ ਅੱਛਾ ਹੁਣ ਤੁਸੀਂ ਨਵਾਂ ਲਿਆ ਨੰਬਰ ਅੱਛਾ ਠੀਕ ਹੈ ਫਿਰ ਤੁਸੀਂ ਮੈਨੂੰ ਨੰਬਰ ਦੇ ਦਿਓ ਮੈਂ ਤੁਹਾਡਾ ਨੰਬਰ ਐਡ ਕਰ ਦੇਵਾਂਗੀ ਗਰੁੱਪ 'ਚ

ਹਾਂਜੀ ਹੋਰ ਤੁਸੀਂ ਰੈਗੂਲਰ ਆਉਣਾ ਹੁਣ ਭੰਗੜਾ ਕਲਾਸ 'ਚ ਛੁੱਟੀ ਨਹੀਂ ਲੈਣੀ ਠੀਕ ਹੈ ਹਾਂ ਹਾਂਜੀ ਕੋਸ਼ਿਸ਼ ਕਰਿਓ ਵੀ ਤੁਸੀਂ ਹੁਣ ਲਗਾਤਾਰ ਆਓ ਕਿਉਂਕਿ ਫਿਰ ਤ ਤੁਹਾਡੇ ਸਾਰੇ ਸਟੈਪ ਸਿਖਾਏ ਜਾਣਗੇ ਨਾ ਤਾਂ ਫਿਰ ਤੁਸੀਂ ਪਿੱਛੇ ਰਹਿ ਸਕਦੇ ਹੋ ਬਾਕੀਆਂ ਨਾਲੋਂ ਫਿਰ ਮੈਂ ਬਾਰ ਬਾਰ ਤਾਂ ਸਿਖਾ ਨਹੀਂ ਨਾ ਸਕਦੀ ਹਾਂਜੀ ਹੋਰ ਕੁਛ ਠੀਕ ਸੱਤਿ ਸ਼੍ਰੀ ਅਕਾਲ